ਸਾਡੇ ਦੇਸ਼ ਵਿੱਚ ਹਰੇਕ ਪਰੰਪਰਾ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਪਰੰਪਰਾ ਵਿੱਚ ਜਿਵੇਂ ਕਿਸੇ ਘਰ ਵਿਆਹ ਹੋਵੇ ਤਾਂ ਇੱਕ ਦੋ ਮਹੀਨੇ ਪਹਿਲਾਂ ਹੀ ਰੌਣਕਾਂ ਲੱਗ ਜਾਂਦੀਆਂ ਨੇ ਅਤੇ ਵਿਆਹ ਤੋਂ ਦੋ ਦਿਨ ਪਹਿਲਾਂ ਮਹਿੰਦੀ ਦੀ ਰਸਮ ਹੁੰਦੀ ਹੈ ਮੁੰਡੇ ਜਾਂ ਕੁੜੀ ਦੀ ਮਹਿੰਦੀ ਦੀ ਰਸਮ ਵੇਲੇ ਹੋਰ ਕੁੜੀਆਂ ਵੀ ਮਹਿੰਦੀ ਲਗਾਉਂਦੀਆਂ ਨੇ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਹਲ਼ਦੀ ਦੀ ਰਸਮ ਹੁੰਦੀ ਹੈ ਹਲ਼ਦੀ ਦੀ ਰਸਮ ਸਮੇਂ ਬੱਚੇ ਦੇ ਪੈਰਾਂ ਅੱਗੇ ਇੱਕ ਬੜੀ ਚਿੱਤਰਕਾਰੀ ਰੰਗੋਲੀ ਬਣਾਈ ਜਾਂਦੀ ਹੈ ਅਤੇ ਰਸਮ ਸ਼ੁਰੂ ਹੁੰਦੀ ਹੈ ਬੜੇ ਚਾਅ ਨਾਲ ਵੀਰੇ ਭੈਣਾਂ ਮਾਸੀਆਂ ਮਾਮੀਆਂ ਸਾਰੇ ਰਲ ਕੇ ਹਲ਼ਦੀ ਦੀ ਰਸਮ ਪੂਰੀ ਕਰਦੀਆਂ ਨੇ ਅਤੇ ਗੀਤ ਗਾਉਂਦੀਆਂ ਨੇ ਮੁੰਡੇ ਦੇ ਵਿਆਹ ਵਿੱਚ ਘੋੜੀਆਂ ਅਤੇ ਕੁੜੀ ਦੇ ਵਿਆਹ ਵਿੱਚ ਸੁਹਾਗ ਗਾਏ ਜਾਂਦੇ ਨੇ ਵਿਆਹ ਵਿੱਚ ਇਕੱਠੇ ਹੋ ਕੇ ਸਾਰੇ ਰਿਸ਼ਤੇਦਾਰ ਗਿੱਧਾ ਭੰਗੜਾ ਪਾਉਂਦੇ ਨੇ ਉਸ ਸਮੇਂ ਸਭ ਆਪਣੇ ਕੰਮਾਂ ਕਾਰਾਂ ਨੂੰ ਭੁੱਲ ਕੇ ਪੂਰੀ ਮਸਤੀ ਕਰਦੇ ਨੇ ਅਤੇ ਸਾਰੇ ਰਲ ਕੇ ਹੀ ਵਿਆਹ ਵਾਲੇ ਘਰ ਦੇ ਕੰਮਾਂਕਾਰਾਂ ਨੂੰ ਨੇਪਰੇ ਚਾੜਦੇ ਨੇ ਖੁਸ਼ੀਆਂ ਦੇ ਸਾਰੇ ਕਾਰਜਾਂ ਨੂੰ ਚੇਤੇ ਰੱਖਣ ਲਈ ਕੈਮਰੇ ਵੀ ਅਤੇ ਫੋਟੋਗ੍ਰਾਫਰੀ ਵਿੱਚ ਸਾਰੇ ਪ੍ਰੋਗਰਾਮਾਂ ਨੂੰ ਬੜੇ ਹੀ ਸਲੀਕੇ ਨਾਲ ਕੈਦ ਕਰ ਲਿਆ ਜਾਂਦਾ ਹੈ ਅਤੇ ਇੱਕ ਹੋਰ ਬੜੀ ਵਧੀਆ ਗੱਲ ਹੈ ਕਿ ਸਾਰੇ ਲੋਕ ਵਿਆਹ ਦੇ ਵਿੱਚ ਹਰ ਇੱਕ ਦੂਜੇ ਨੂੰ ਪੂਰੇ ਬੜੇ ਪਿਆਰ ਨਾਲ ਸੰਭਾਲਦੇ